ਸਭ ਤੋਂ ਮਸ਼ਹੂਰ ਭੰਗੜੇ ਦੇ ਗੀਤ ਗੁੱਡੀਆਂ ਪਟੋਲੇ ਲੌਂਗ ਲਾਚੀ ਪੰਜ ਤਾਰਾ ਠੇਕੇ ਉੱਤੇ ਅਤੇ ਮੇਰੀ ਕਾਲੀ ਐਕਟੀਵਾ ਹੈ ਪਰ ਮੇਰਾ ਮਨ ਪਸੰਦ ਗੀਤ ਮੇਰੀ ਕਾਲੀ ਐਕਟੀਵਾ ਹੈ ਇਹਦੇ ਇਹ ਗੀਤ 'ਤੇ ਮੈਂ ਬਹੁਤ ਵਾਰੀ ਭੰਗੜਾ ਕੀਤਾ ਹੋਇਆ ਹੈ ਅਤੇ ਮੈਂ ਵੀਡੀਓ ਵੀ ਬਣਾਈਆਂ ਹੋਈਆਂ ਹਨ ਅਤੇ ਇਹ ਗਾਣਾ ਟਰੈਂਡਿੰਗ 'ਤੇ ਹੈ ਲੋਕ ਇਹ ਗਾਣਾ ਬਹੁਤ ਖੁਸ਼ ਹੋ ਕੇ ਗਾਉਂਦੇ ਵੀ ਹਨ ਅਤੇ ਇਸ ਗਾਣੇ 'ਤੇ ਭੰਗੜਾ ਵੀ ਕਰਦੇ ਹਨ ਇਹ ਵਿਆਹ ਸ਼ਾਦੀ 'ਚ ਵੀ ਬਹੁਤ ਵਾਰ ਲੱਗਦਾ ਹੈ ਅਤੇ ਉਹਦੇ 'ਤੇ ਵੀ ਲੋਕ ਵਿਆਹ ਸ਼ਾਦੀ 'ਚ ਵੀ ਜਾ ਕੇ ਲੋਕ ਇਹ ਹੀ ਗਾਣੇ 'ਤੇ ਜ਼ਿਆਦਾ ਡਾਂਸ ਕਰਦੇ ਹਨ ਅਤੇ ਇਹ ਗਾਣਾ ਸਪੈਸ਼ਲੀ ਮੈਂ ਆਪਣੀ ਭਤੀਜੀ ਨੂੰ ਵੀ ਸਿਖਾਇਆ ਹੈ ਅਤੇ ਉਸਨੇ ਇਹ ਗਾਣੇ 'ਤੇ ਡਾਂਸ ਕਰਕੇ ਸਕੂਲ ਵਿੱਚ ਡਾਂਸ ਕੀਤਾ ਸਿੱ ਇਹ ਗਾਣੇ 'ਤੇ ਸਿੱਖ ਕੇ ਸਕੂਲ ਵਿੱਚ ਡਾਂਸ ਕੀਤਾ ਮੇਰੀ ਕਾਲੀ ਐਕਟੀਵਾ ਦਾ ਤੇ ਅਤੇ ਉਹਨੂੰ ਇਹ ਗਾਣੇ ਤੋਂ ਫਸਟ ਪ੍ਰਾਈਜ਼ ਮਿਲਿਆ ਇਹ ਗਾਣਾ ਸਭ ਤੋਂ ਵੈਸੇ ਤਾਂ ਇਹ ਗਾਣਾ ਪੁਰਾਣਾ ਹੈ ਪਰ ਇਸ ਟਾਈਮ 'ਤੇ ਇਹ ਗਾਣਾ ਦੁਬਾਰਾ ਟਰੈਂਡਿੰਗ 'ਤੇ ਆ ਗਿਆ ਜੋ ਕਿ ਲੋਕ ਬਹੁਤ ਪਸੰਦ ਕਰਦੇ ਹਨ ਸੁਣਨ 'ਚ ਅਤੇ ਇਹ ਗਾਣਾ ਮੇਰਾ ਵੀ ਬਹੁਤ ਮਨ ਪਸੰਦ ਹੈ ਅਤੇ ਮੈਂ ਇਹ ਗਾਣੇ 'ਤੇ ਬਹੁਤ ਨੱਚਦੀ ਵੀ ਹਾਂ ਅਤੇ ਮੈਂ ਲੋਕਾਂ ਨੂੰ ਵੀ ਇਹ ਗਾਣੇ 'ਤੇ ਡਾਂਸ ਸਿਖਾਉਂਦੀ ਹਾਂ ਭੰਗੜਾ ਸਿਖਾਉਂਦੀ ਹਾਂ ਇਸ ਗਾਣੇ 'ਤੇ